ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੋਬਾਇਲ ਸ਼ੋਪ ਤੋਂ ਬੋਲਦੇ ਹਾਂਜੀ ਜੀ ਮੈਂ ਨਾ ਇੱਕ ਫੋਨ ਲੈਣਾ ਸੀ ਹਾਂਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਇਸ ਟਾਈਮ ਕਿਹੜਾ ਮਤਲਬ ਚੱਲ ਰਿਹਾ ਫੋਨ ਜ਼ਿਆਦਾ ਡਿਮਾਂਡ ਵਿੱਚ ਹੈਗਾ ਵੈਸੇ ਤਾਂ ਮੈਂ ਜ਼ਿਆਦਾ ਨਹੀਂ ਕੋਸਟਲੀ ਨਹੀਂ ਲੈਣਾ ਚਾਹੁੰਦੀ ਜੇ ਮੈਨੂੰ ਅੱਛਾ ਲੱਗਾ ਤਾਂ ਲੈ ਵੀ ਸਕਦੀ ਹਾਂ ਹੈ ਨਾ ਮਤਲਬ ਜੋ ਮਤਲਬ ਬੈਸਟ ਹੈ ਉਹ ਮੈਨੂੰ ਦੱਸੋ ਕੀ ਹਾਂਜੀ ਨਹੀਂ ਨਹੀਂ ਨਹੀਂ ਜਿਆਦਾ ਵੀ ਚੱਲੇਗਾ ਹਾਂਜੀ ਫਿਫਟੀ ਪਲੱਸ ਵੀ ਚੱਲੇਗਾ ਹਾਂਜੀ ਹਾਂਜੀ ਠੀਕ ਆ ਜੀ ਅਤੇ ਕੈਮਰਾ ਕਿਹਦਾ ਬੈਸਟ ਹੋਏਗਾ ਜੀ ਕੈਮਰਾ ਹਾਂਜੀ ਹਾਂਜੀ ਕਿਉਂਕਿ ਉਹ ਥੋੜ੍ਹਾ ਨਾ ਪਿਚਰ ਮੈਨੂੰ ਪਿਚਰ ਵਗੈਰਾ ਲੈਣ ਦਾ ਬੜਾ ਸ਼ੌਂਕ ਹੈ ਨਾ ਜੀ ਇਸ ਕਰਕੇ ਹਾਂਜੀ ਹਾਂਜੀ ਹੂੰ ਹੂੰ ਹਾਂਜੀ ਠੀਕ ਹੈ ਜੀ ਹਾਂਜੀ ਸੁਣਿਆ ਤਾਂ ਮੈਂ ਵੀ ਆ ਆਈਫੋਨ ਦਾ ਹੀ ਕੈਮਰਾ ਬੈਸਟ ਹੈਗਾ ਹਾਂਜੀ ਚਲੋ ਠੀਕ ਆ ਜੀ ਮੈਂ ਆਵਾਂਗੀ ਤੁਹਾਡੀ ਸ਼ੋਪ 'ਤੇ ਹਾਂਜੀ ਫਿਰ ਮੈਂ ਦੇਖਾਂਗੀ ਮੈਨੂੰ ਜੋ ਬੈਸਟ ਲੱਗਿਆ ਫਿਰ ਮੈਂ ਉਹ ਲੈ ਕੇ ਜਾਵਾਂਗੀ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਆ ਜੀ ਤੁਹਾਡੀ ਸ਼ੋਪ ਕਿੰਨੇ ਤੋਂ ਕਿੰਨੇ ਤੱਕ ਖੁੱਲੀ ਰਹਿੰਦੀ ਹੈ ਠੀਕ ਆ ਜੀ ਅਤੇ ਮਤਲਬ ਕੋਈ ਬੰਦ ਤਾਂ ਨਹੀਂ ਹੁੰਦੀ ਕਿਸੇ ਦਿਨ ਵੀ ਅੱਛਾ ਜੀ ਚਲੋ ਠੀਕ ਆ ਜੀ ਮੈਂ ਫਿਰ ਆਵਾਂਗੀ ਜੀ ਤੁਹਾਡੀ ਦੁਕਾਨ 'ਤੇ ਅਵੇਲੇਬਲ ਆ ਨਾ ਸਾਰੇ ਤੁਹਾਡੇ ਕੋਲ ਫੋਨ ਚਲੋ ਠੀਕ ਆ ਜੀ ਠੀਕ ਆ ਜੀ ਅਸੀਂ ਮਿਲਦੇ ਆ ਫਿਰ ਓਕੇ ਜੀ ਥੈਂਕ ਯੂ